ਹੈਲੋ ਸਰ ਸਤਿ ਸ਼੍ਰੀ ਅਕਾਲ ਸਰ ਵੀ ਪੰਨ ਹਲਪ ਵੀ ਸਾਡੇ ਸਰਕਾਰੀ ਹੋਸਪੀਟਲਾਂ ਵਿੱਚ ਆਪਾਂ ਇਵੇਂ ਕਿਸੇ ਗਰੀਬ ਜਨਤਾ ਗਰੀਬ ਬੰਦੇ ਦਾ ਇਲਾਜ ਕਰਵਾਉਣਾ ਤਾਂ ਫ੍ਰੀ ਇਲਾਜ ਕੀਤਾ ਜਾਂਦਾ ਹੈਗਾ ਵੀ ਦਸ ਰੁਪਏ 'ਚ ਪਰਚੀ ਲਓ ਤਾਂ ਅਸੀਂ ਵੱਡੇ ਤੋਂ ਵੱਡਾ ਇਲਾਜ ਫ੍ਰੀ ਕਰਵਾ ਸਕਦੇ ਹਾਂ ਪਰ ਕਈ ਵਾਰ ਸਰਕਾਰੀ ਹੋਸਪੀਟਲਾਂ ਵਿੱਚ ਜੇ ਕੋਈ ਹੜ ਦਾ ਪ੍ਰੋਬਲਮ ਦਾ ਇਲਾਜ ਕਰਵਾਉਣਾ ਹੋਵੇ ਜਾਂ ਕੋਈ ਹੋਰ ਇਲਾਜ ਕਰਵਾਉਣਾ ਹੋਵੇ ਤਾਂ ਸਾਡੇ ਇੱਥੇ ਐਵੇਲੇਬਲ ਨਹੀਂ ਹੈਗੇ ਗੇ ਅਤੇ ਸਾਨੂੰ ਬਾਹਰ ਜਾਣਾ ਪੈਂਦਾ ਜਿੱਥੇ ਕਿ ਬਹੁਤ ਹਾਈ ਲੈਵਲ ਉੱਪਰ ਇਲਾਜ ਕੀਤੇ ਜਾਂਦੇ ਉਹ ਅਸੀਂ ਇਲਾਜ ਨਹੀਂ ਕਰਵਾ ਸਕਦੇ ਹੈਗੇ ਹਾਂਜੀ ਸਰ ਹਾਂਜੀ ਸਰਕਾਰੀ ਹੋਸਪੀਟਲਾਂ ਵਿੱਚ ਮਤਲਬ ਜਿਹੜੇ ਸਾਡੇ ਵਰਗੇ ਛੋਟੇ ਲੋਕ ਹੁੰਦੇ ਹੈਗੇ ਉਹ ਇੰਨੀ ਪ੍ਰਾਈਵੇਟ ਹੋਸਪੀਟਲਾਂ ਵਿੱਚ ਇਲਾਜ ਨਹੀਂ ਕਰਵਾ ਸਕਦੇ ਜ਼ਿਆਦਾ ਖਰਚਾ ਹੁੰਦਾ ਹੈਗਾ ਉਹਨਾਂ ਲਈ ਸਰਕਾਰੀ ਹੋਸਪੀਟਲ ਸਭ ਤੋਂ ਵਧੀਆ ਹੋਸਪੀਟਲ ਆ ਹੁਣ ਪਰ ਸਰਕਾਰ ਹੁਣ ਤਾਂ ਸਰਕਾਰ ਨੇ ਪੰਜ ਲੱਖ ਵਾਲਾ ਕਾਰਡ ਵੀ ਬਣਾ ਰੱਖਿਆ ਵੀ ਅਸੀਂ ਵੀ ਇੱਕ ਪੰਜ ਲੱਖ ਤੱਕ ਕੋਈ ਆਪਣਾ ਇਲਾਜ ਫ੍ਰੀ ਕਰਵਾ ਸਕਦੇ ਹਾਂ ਆਪਣੇ ਗੋਡੇ ਪਵਾ ਸਕਦੇ ਹਾਂ ਅੱਖਾਂ ਦਾ ਇਲਾਜ ਕਰਵਾ ਸਕਦੇ ਹਾਂ ਵੀ ਕੋਈ ਮਰਜ਼ੀ ਇਲਾਜ ਕਰਵਾ ਸਕਦੇ ਹਾਂ ਪੰਜ ਲੱਖ ਤੱਕ ਤੱਕ ਸਾਡਾ ਇਲਾਜ ਹੁੰਦਾ ਹੋਵੇ ਹਾਂਜੀ ਸਰ ਹਾਂਜੀ ਹਾਂਜੀ ਪਰ ਕਈ ਜੇਕਰ ਅਸੀਂ ਵੀ ਸਰਕਾਰੀ ਹਸਪਤਾਲਾਂ ਵਿੱਚ ਦੇਖਦੇ ਹਾਂ ਤਾਂ ਉੱਥੋਂ ਦਾ ਰਹਿਣ ਸਹਿਣ ਅਤੇ ਪ੍ਰਾਈਵੇਟ ਹੋਸਪੀਟਲਾਂ ਦਾ ਬਹੁਤ ਫਰਕ ਆ ਸਰਕਾਰੀ ਹੋਸਪੀਟਲਾਂ ਵਿੱਚ ਵੀ ਇੱਕ ਤਾਂ ਮਰੀਜ਼ ਉੱਪਰ ਇੱਕ ਸਪੈਸ਼ਲ ਡੋਕਟਰ ਜਾਂ ਨਰਸ ਸਿਸਟਰ ਨਹੀਂ ਰੱਖਿਆ ਜਾਂਦਾ ਹੈਗਾ ਕਿਉਂਕਿ ਨਾ ਉੱਥੇ ਵੀ ਇੱਕ ਇੱਕ ਬਿਮਾਰ ਪੇਸੰਟ ਪੇਸ਼ੰਟ ਲਈ ਕੋਈ ਪੱਖੇ ਦਾ ਪ੍ਰਬੰਧ ਕੀਤਾ ਜਾਂਦਾ ਹਾਂਜੀ ਸਰ ਜੇ ਅਸੀਂ ਆਏਂ ਦੇ ਜੇ ਅਸੀਂ ਜਾਕਰ ਉੱਥੇ ਦੇਖਦੇ ਹਾਂ ਵੀ ਉੱਥੋਂ ਦੇ ਵੋ ਵੋਸ਼ਰੂਮ ਫਲਸ਼ ਬਹੁਤ ਹੀ ਕਲੀਨ ਨਹੀਂ ਹੁੰਦੇ ਹੈਗੇ ਉਹ ਉੱਥੇ ਵੀ ਨਹਾਉਣ ਤੱਕ ਦਾ ਬੰਦੇ ਨੂੰ ਜੀਅ ਨਹੀਂ ਕਰਦਾ ਕਿਉਂਕਿ ਉਹ ਸਰਕਾਰੀ ਹੋਸਪੀਟਲ ਆ ਉੱਥੇ ਇੰਨਾ ਜ਼ਿਆਦਾ ਜਰੂ ਮਾਹੌਲ ਨਹੀਂ ਇਹ ਲੋੜਾਂ ਨਹੀਂ ਪੂਰੀਆਂ ਕੀਤੀਆਂ ਜਾਂਦੀਆਂ ਹਾਂਜੀ ਸਰ ਜਦੋਂ ਵੀ ਕਿਸੇ ਆਪਾਂ ਜੱਚਾ ਬੱਚਾ ਹੋਸਪੀਟਲ ਵਿੱਚ ਜਾਂਦੇ ਹਾਂ ਉੱਥੇ ਲੇਡੀਜ਼ ਲਈ ਵੀ ਇੱਕ ਸਪੈਸ਼ਲ ਨਰਸ ਦਾ ਹੋਣਾ ਬਹੁਤ ਜ਼ਰੂਰੀ ਆ ਉਹਨਾਂ ਲਈ ਫਿਰ ਉਹਨਾਂ ਨੂੰ ਵੋਸ਼ਰੂਮ ਤੱਕ ਲੈ ਕੇ ਜਾਣ ਉਹਨਾਂ ਦੇ ਰਾਊਡ ਲਵਾਉਣ ਪਰ ਉੱਥੇ ਐਵੇਂ ਦਾ ਕੋਈ ਵੀ ਉੱਥੇ ਪ੍ਰਬੰਧ ਨਹੀਂ ਹੈਗਾ ਹਾਂਜੀ ਸ ਨਾਂ ਉੱਥੇ ਮਤਲਬ ਇੱਕ ਲੇਡੀਜ਼ ਲਈ ਪੱਖਾ ਹੋਵੇ ਉੱਥੋਂ ਦਾ ਵੀ ਕਿਸ ਤਰ੍ਹਾਂ ਦਾ ਕੋਈ ਵੀ ਪ੍ਰਬੰਧ ਨਹੀਂ ਹੈਗਾ ਹਾਂਜੀ ਸਰ ਹਾਂਜੀ ਹਾਂਜੀ ਹਾਂਜੀ ਸਰ ਪਰ ਜੇ ਇੱਕ ਗੱਲ ਅਸੀਂ ਸਰਕਾਰੀ ਪ੍ਰਾਈਵੇਟ ਹੋਸਪੀਟਲ ਦੀ ਕਰਦੇ ਹਾਂ ਤਾਂ ਉੱਥੇ ਅਸੀਂ ਜੇ ਕਿਸੇ ਪੇਸੰਟ ਨੂੰ ਐਡਮਿੰਟ ਕਰਵਾਉਣਾ ਤਾਂ ਉੱਥੇ ਇੱਕ ਨਰਸ ਉੱਪਰ ਰੱਖੀ ਜਾਂਦੀ ਹੈਗੀ ਕਿਉਂਕਿ ਉਹ ਪ੍ਰਾਈਵੇਟ ਹੋਸਪੀਟਲ ਆ ਉੱਥੇ ਜ਼ਿਆਦਾ ਸੁੱਖ ਸੁਵਿਧਾ ਦਿੱਤੀਆਂ ਜਾਂਦੀਆਂ ਉੱਥੋਂ ਦੇ ਜੇ ਕੋਈ ਆਪਾਂ ਇਲਾਜ ਕਰਵਾਉਣਾ ਤਾਂ ਉਹਨਾਂ ਦਾ ਰੇਟ ਬਹੁਤ ਹਾਈ ਲੇਵਲ ਹੁੰਦਾ ਕਿਉਂਕਿ ਜਿਹੜੇ ਗਰੀਬ ਲੋਕ ਹੁੰਦੇ ਉਹ ਨਹੀਂ ਕਰਵਾ ਸਕਦੇ ਹਾਂਜੀ ਸਰ ਵੀ ਮੇਰੀ ਸਰਕਾਰ ਵੱਲੋਂ ਇਹੀ ਅਪੀਲ ਆ ਵੀ ਸਰਕਾਰੀ ਹੋਸਪੀਟਲ ਨੂੰ ਪ੍ਰਾਈਵੇਟ ਪ੍ਰਾਈਵੇਟ ਹੋਸਪੀਟਲ ਦੇ ਬਰਾਬਰ ਕੀਤਾ ਜਾਵੇ ਤਾਂ ਜੋ ਵੀ ਉੱਥੇ ਸੋ ਗਰੀਬ ਜਨਤਾ ਆਪਦਾ ਇਲਾਜ ਸਹੀ ਤਰੀਕੇ ਨਾਲ ਕਰਵਾ ਸਕੇ ਹਾਂਜੀ ਸਰ ਕਈ ਵਾਰ ਆਪਾਂ ਦੇਖਦੇ ਹਾਂ ਵੀ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਹੁੰਦੀ ਤਾਂ ਉਹ ਇਲਾਜ ਕਰਵਾਉਣ ਲਈ ਆਪਣਾ ਕਿਸੇ ਹੋਰ ਸ਼ਹਿਰ ਵੱਲ ਲੈ ਜਾਂਦੇ ਉਹ ਪ੍ਰਾਈਵੇਟ ਹੋਸਪੀਟਲ ਲਿਜਾਂਦੇ ਆ ਉੱਥੇ ਇਲਾਜ ਬਹੁਤ ਹੀ ਮਹਿੰਗੇ ਹੁੰਦੇ ਲੱਖ ਡੇਢ ਲੱਖ ਰੁਪਏ ਤੱਕ ਇਸ ਤੋਂ ਵੀ ਜ਼ਿਆਦਾ ਹਾਈ ਲੇਵਲ ਉੱਪਰ ਇਲਾਜ ਕੀਤਾ ਜਾਂਦਾ ਇੰਨੇ ਪੈਸੇ ਗਰੀਬ ਜਨਤਾ ਨਹੀਂ ਭਰ ਸਕਦੀ ਹਾਂਜੀ ਸਰ ਪਰ ਅੱਜ ਕੱਲ੍ਹ ਅਸੀਂ ਦੇਖੀਏ ਤਾਂ ਵੀ ਇਹ ਪਿੰਡਾਂ ਵਿੱਚ ਵੀ ਇੱਕ ਨੋਰਮਲ ਹੋਸਪੀਟਲ ਸਰਕਾਰੀ ਖੁੱਲ੍ਹ ਗਿਆ ਜਿੱਥੇ ਵੀ ਆਮ ਲੋਕ ਆਪਦਾ ਰੈਗੂਲਰ ਚੈੱਕਅਪ ਕਰਵਾ ਸਕਦੇ ਹੈ ਵੀ ਜੇ ਕਿਸੇ ਨੂੰ ਥੋੜ੍ਹੀ ਮੋਟੀ ਫੀਵਰ ਵਗੈਰਾ ਪ੍ਰੋਬਲਮ ਹੋਵੇ ਤਾਂ ਉੱਥੋਂ ਦਵਾਈ ਲੈ ਸਕਦੇ ਆ ਹਾਂਜੀ ਸਰ ਹਾਂਜੀ ਹਾਂਜੀ ਵੀ ਸਰ ਵੀ ਸਰਕਾਰੀ ਹੋਸਪੀਟਲਾਂ ਵਿੱਚ ਵੀ ਬਈ ਇੱਕ ਨਵੀਂ ਤੋਂ ਨਵੀਂ ਤੋਂ ਨਵੀਂ ਟੈਕਨੋਲਜੀ ਆਉਂਦੀ ਮਸ਼ੀਨਾਂ ਆਉਂਦੀਆਂ ਵੀਲਚੇਅਰ ਵਗੈਰਾਂ ਆਉਂਦੀਆਂ ਹੈਗੀਆਂ ਉਹਦੀ ਵੀ ਵੀ ਉਹਨਾਂ ਨੂੰ ਦਿੱਤੀਆਂ ਜਾਣ ਤਾਂ ਜੋ ਮਰੀਜ਼ ਨੂੰ ਉੱਪਰ ਤੋਂ ਨੀਚੇ ਆਉਣ ਤੱਕ ਕੋਈ ਮੁਸੀਬਤ ਮੁਸੀਬਤ ਨਾ ਹੋਵੇ ਅਤੇ ਤਕਲੀਫ ਨਾ ਹੋਵੇ ਕੋਈ ਹਾਂਜੀ ਸਰ ਹਾਂਜੀ ਹਾਂਜੀ ਆਪਾਂ ਵੇਖਦੇ ਹਾਂ ਕੋਈ ਜੇ ਜਿਵੇਂ ਕੋਈ ਪ੍ਰੈ ਪ੍ਰੈਗਨੈਂਟ ਲੇਡੀ ਹੈ ਤਾਂ ਉਹਨੂੰ ਤਾਂ ਉੱਥੋਂ ਆਉਣਾ ਸੀਟ ਤੱਕ ਆਉਣਾ ਬਹੁਤ ਮੁਸ਼ਕਿਲ ਆ ਤਾਂ ਉਹਨਾਂ ਲਈ ਸਰਕਾਰੀ ਹੋਸਪੀਟਲਾਂ ਵਿੱਚ ਲਿਫਟ ਲਗਾਈ ਜਾਵੇ ਤਾਂ ਜੋ ਉਹਨਾਂ ਨੂੰ ਆਉਣ ਵਿੱਚ ਅਤੇ ਜਾਣ ਵਿੱਚ ਕੋਈ ਤਕਲੀਫ ਨਾ ਹੋਵੇ ਹਾਂਜੀ ਸਰ ਬਸ ਮੇਰੀ ਸਰਕਾਰ ਵੱਲੋਂ ਇਹੀ ਅਪੀਲ ਕੀਤੀ ਜਾਂਦੀ ਹੈ ਵੀ ਸਰਕਾਰੀ ਹੋਸਪੀਟਲਾਂ ਵਿੱਚ ਵੀ ਪੂਰਾ ਪ੍ਰਬੰਧ ਕੀਤਾ ਜਾਵੇ ਜਾਂ ਤਾਂ ਜੋ ਆਮ ਜਨਤਾ ਆਪਦਾ ਇਲਾਜ ਸਹੀ ਤਰੀਕੇ ਨਾਲ ਕਰਵਾ ਸਕੇ ਹਾਂਜੀ ਸਰ ਥੈਂਕ ਯੂ ਸੋ ਮੱਚ ਸਰ